ਸਰਕਾਰ ਦੁਆਰਾ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਜਿਵੇਂ ਕਿ ਸਰਕਾਰੀ ਹਸਪਤਾਲਾਂ ਵਿੱਚ ਬਹੁਤ ਸਾਰਾ ਸੁਧਾਰ ਆਇਆ ਹੈ ਜੋ ਪਹਿਲੇ ਸਮੇਂ ਵਿੱਚ ਨਹੀਂ ਸੀਗਾ ਅੱਜ ਕੱਲ੍ਹ ਸਾਰਾ ਸਿਸ ਕੰਮ ਹੀ ਕੰਪਿਊਟਰਾਂ 'ਤੇ ਹੋ ਗਿਆ ਹੈ ਲਾਈਨਾਂ ਵਿੱਚ ਖੜ੍ਹਨ ਦੀ ਵੀ ਲੋੜ ਨਹੀਂ ਪੈਂਦੀ ਅਤੇ ਦੇਖਿਆ ਜਾਵੇ ਤਾਂ ਡਾਕਟਰ ਵੀ ਵੱਡੇ ਤੋਂ ਵੱਡੇ ਆ ਗਏ ਹਨ ਹੋਸਪਿਟਲਾਂ ਦੇ ਵਿੱਚ ਜੋ ਕਿ ਹੁਣ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਹੋਸਪਿਟਲ 'ਚ ਇੰਨਾ ਖਾਸ ਫਰਕ ਨਹੀਂ ਰਿਹਾ ਹੈਗਾ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਹਰ ਕੋਈ ਸਰਕਾਰੀ ਹਸਪਤਾਲਾਂ ਵਿੱਚ ਹੀ ਆਉਂਦਾ ਹੈ ਕਿਉਂਕਿ ਇਲਾਜ ਵਧੀਆ ਹੋ ਜਾਂਦਾ ਹੈ ਟ੍ਰੀਟਮੈਂਟ ਵਧੀਆ ਹੁੰਦਾ ਹੈ ਇੱਥੇ ਵੀ ਅਤੇ ਪੈਸੇ ਵੀ ਬਹੁਤ ਘੱਟ ਲੱਗਦੇ ਨੇ ਪ੍ਰਾਈਵੇਟ ਨਾਲ਼ੋਂ